ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਿਲਕੁਲ ਅੱਛਾ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਦੱਸਦਾ ਤੁਹਾਨੂੰ ਹੁਸ਼ਿਆਰਪੁਰ ਸੈਡ ਨਾ ਤੁਸੀਂ ਦੇਖੂੰਗੇ ਪੂਰੀ ਦੁਆਬਾ ਬੈਲਟ ਈ ਐ ਨਾ ਇਹ ਸਾਰੀ ਬਾਹਰ ਫਰੀ ਪਈ ਹੋਈ ਐ ਅੱਜ ਦਾ ਟਰੈਂਡ ਤਾਂ ਏਹੀ ਐ ਤੁਸੀਂ ਦੇਖੂੰਗੇ ਤਕਰੀਬਨ ਯੰਗਸਟਰ ਜਿੰਨੇ ਵੀ ਹੈਗੇ ਐ ਸਾਰੇ ਉਨ੍ਹਾਂ ਦਾ ਏਮ ਇਹ ਰਹਿ ਗਿਆ ਕਿ ਪਲੱਸ ਟੂ ਕਰਕੇ ਸਿਰਫ਼ ਬਾਹਰ ਜਾਣਾ ਐ

ਕਾਰਨ ਇਹ ਇਹਦੀ ਹਿਸਟਰੀ ਹੈਗੀ ਬੈਕਗਰਾਉਂਡ ਦੀ ਤੇ ਦੇਖਿਆ ਜਾਵੇ ਨਾ ਪਹਿਲਾਂ ਨੀ ਐਦਾਂ ਰੁਝਾਨ ਸੀਗਾ ਜਿਆਦਾਤਰ ਜਦੋਂ ਦੀ ਐਮਰਜੈਂਸੀ ਤੋਂ ਬਾਅਦ ਸੈਵਨਟੀ ਫਾਈਵ ਜਾਂ ਏਟੀ ਫੋਰ ਇਹ ਦੌਰ ਤੋਂ ਬਾਦ ਜਿਹੜਾ ਚਰਾਸੀ ਤੋਂ ਬਾਦ ਦੇਖਿਆ ਜਾਵੇ ਦੁਆਬੇ ਦੇ ਲੋਕਾਂ ਨੂੰ ਕਾਫ਼ੀ ਪੜਤਾੜਨਾ ਝੱਲਣੀ ਪਈ ਉਹਦੇ ਕਾਰਨ ਲੋਕਾਂ ਨੇ ਨਾ ਨੌਕਰੀਆਂ ਛੱਡ ਕੇ ਵੀ ਬਾਹਰ ਜਾਣਾ ਪ੍ਰੈਫਰ ਕੀਤਾ ਵੀ ਬਾਹਰਲੇ ਦੇਸ਼ਾਂ ਨੇ ਵੀ ਸਪੋਟ ਕਰਤਾ ਵੇ ਹਾਂ ਤੁਸੀਂ ਆ ਸਕਦੇ ਆਂ ਓਸ ਉਹਤੋਂ ਹੌਲੀ ਹੌਲੀ ਟਰੈਂਡ ਸ਼ੁਰੂ ਹੋਇਆ ਹਾਂਜੀ ਬਿਲਕੁਲ ਇਹ ਵੀ ਰੀਜ਼ਨ ਹੈਗਾ ਕਿਉਂਕੀ ਬੱਚਿਆਂ ਕੋ ਹੈਗੇ ਪੈਸੇ ਮੋਸਟਲੀ ਹੁਣ ਜੇ ਦੇਖਿਆ ਜਾਵੇ ਹੁਸ਼ਿਆਰਪੁਰ ਚੇ ਹੀ ਤੇ ਸਾਰੇ ਕਿਤੇ ਨਾ ਕਿਤੇ ਜੌਬ ਤੇ ਲੱਗੇ ਪਏ ਐ ਜੇ ਕਿਤੇ ਨਾ ਕਿਤੇ ਹੈਗੇ ਐ ਵੈਲਸੈਟਲ ਉਨ੍ਹਾਂ ਕੋਲ ਪੈਸੇ ਹੈ ਤਾਹੀਂ ਬਾਹਰ ਭੇਜ ਰਹੇ ਨੇ ਹਾਂ ਨਈਂ ਜਾ ਸਕਦੇ ਇਹ ਵੀ ਹੈਗਾ ਅਤੁਲ ਯੂਥ ਵੀ ਇੱਕ ਦੂਜੇ ਨੂੰ ਦੇਖ ਕੇ ਨਾ ਹੁਣ ਲੈਵਿਸ਼ ਲਾਈਫ ਸਟਾਈਲ ਜਦੋਂ ਕੋਈ ਦੇਖਦਾ ਬਾਹਰ ਦੇ ਯਾਰ ਦੋਸਤ ਕਿਸੇ ਦਾ ਆ ਗਿਆ ਉਹ ਕਹਿੰਦੇ ਹਾਂ ਇਹ ਵੀ ਇੱਕ ਹੈ ਅਟ੍ਰੈਕਸ਼ਨ ਦੂਜੇ ਨੂੰ ਦੇਖਦੇ ਹੈਗੇ ਤਾਂ ਜਿਆਦਾ ਟਰੈਂਡ ਹੁਣ ਬਣੀ ਜਾ ਰਿਹਾ ਲੋਕੀਂ ਬਾਹਰ ਜਾਣਾ ਪਸੰਦ ਕਰ ਰਹੇ ਐ ਬਿਲਕੁਲ ਭੇਡਚਾਲ ਜੀ ਹੋ ਜਾਂਦੀ ਨਾ ਜਿੱਦਾਂ ਆਪਾਂ ਕਹਿੰਦੇ ਆਂ ਵੀ ਦੇਖੋ ਜੇ ਵੈਲਸੈਟਲਡ ਜਿਹੜੇ ਪਹਿਲਾਂ ਗਏ ਨੇ ਉਹ ਤਾਂ ਹੁਣ ਹੋ ਗਏ ਨੇ ਵੈਲਸੈਟਲ ਪਰ ਇੱਥੇ ਟਾਈਮ ਲੱਗਦਾ ਉਹ ਦੇ ਦੇਖਿਆ ਜਾਵੇ ਤਾਂ ਪਰ ਜਿਹੜੀ ਐਨੀ ਮੇਹਨਤ ਉੱਥੇ ਜਾ ਕੇ ਕਰਦੇ ਮੈਨੂੰ ਲੱਗਦਾ ਐਥੇ ਈ ਕਰਨੀ ਵਧੀਆ ਐ ਓਥੇ ਵੀ ਪੰਜ ਦਸ ਸਾਲ ਤਾਂ ਪਹਿਲਾਂ ਸੈੱਟ ਹੋਣਾ ਔਖਾ ਐ ਹੁਣ ਤਾਂ ਬਿਲਕੁਲ ਮੈਂ ਸਾਡੇ ਪਿੰਡ ਤੋਂ ਇੱਕ ਗਏ ਸੀਗੇ ਉਨ੍ਹਾਂ ਨੂੰ ਦਸ ਸਾਲ ਬਾਅਦ ਜਾ ਕੇ ਹੁਣ ਪੀ ਆਰ ਹੋਏ ਬਹੁਤ ਟਾਈਮ ਲੱਗ ਗਿਆ ਕਾਫੀ ਉੱਥੇ ਸ਼ਿੱਦਤ ਤੋਂ ਬਾਅਦ ਹੂੰ ਉਹੀ ਏ ਬਿਲਕੁੱਲ ਪੀ ਆਰ ਤਾਂ ਹੋ ਵੀ ਰਹੀ ਐ ਜਿਹੜੇ ਸਹੀ ਰਸਤੇ ਨਾਲ ਜਾਂਦੇ ਐ ਉਹ ਤਾਂ ਹੋ ਜਾਂਦੇ ਐ ਪਰ ਜਿਹੜੇ ਹੁਣ ਡੰਕੀ ਡੁੰਕੀ ਲਾ ਕੇ ਜਾਂਦੇ ਨੇ ਉਨ੍ਹਾਂ ਦਾ ਮੁਸ਼ਕਿਲ ਆਂਦੀ ਐ ਹਾਂਜੀ ਉਹਦੀ ਸਟੋਰੀਸ ਤੁਸੀਂ ਕਵਰ ਕਰ ਸਕਦੇ ਕਿਤੇ ਜੇ ਕੋਈ ਏਦਾਂ ਦਾ ਤੁਹਾਨੂੰ ਮਿਲੇ ਕੋਈ ਕੇਸ ਹਾਂਜੀ ਹਾਂਜੀ ਜਰੂਰ ਜਰੂਰ ਮੈਂ ਹੁਣੀ ਜਰੂਰ ਕਰਾਂਗਾ ਠੀਕ ਐ ਥੈਂਕਿਊ ਕੋਈ ਗੱਲ ਨੀ ਥੈਂਕਿਊ ਓਕੇ